ਟਰੇਨਰ ਦੀ ਭੂਮਿਕਾ ਕਿਸੇ ਵੀ ਖੇਡ ਵਿੱਚ ਬਹੁਤ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਹਨਾਂ ਨੇ ਖਿਡਾਰੀਆਂ ਦੇ ਵਿਕਾਸ ਅਤੇ ਤਿਆਰੀ ਵਿੱਚ ਵਧਦੀ ਹੋਈ ਹੈ ਟਰੇਨਰ ਦੀ ਮੁੱਖ ਭੂਮਿਕਾ ਇਹ ਹੁੰਦੀ ਹੈ ਕੀ ਉਹ ਖਿਡਾਰੀਆਂ ਨੂੰ ਸਹੀ ਤਰੀਕੇ ਨਾਲ ਟਰੇਨ ਕਰੇ ਅਤੇ ਉਹਨਾਂ ਨੂੰ ਤਿਆਰੀ ਕਰਾ ਕਰਵਾਏ ਜਿਸ ਨਾਲ ਉਹ ਖੇਡ ਵਿੱਚ ਸਫਲ ਹੋ ਸਕਣ ਇਹਨਾਂ ਦੀ ਕੁਝ ਮੁੱਖ ਭੂਮਿਕਾਵਾਂ ਹਨ ਅਤੇ ਵਿਕਾਸ ਟਰੇਨਰ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਖਿਡਾਰੀਆਂ ਨੂੰ ਆਪਣੇ ਹੁਨਰ ਅਤੇ ਕਸਟਰ ਨੂੰ ਸੁਧਰਨ ਵਿੱਚ ਮਦਦ ਕਰੇ ਉਹ ਵਧੇਰੇ ਤਰੀਕੇ ਨਾਲ ਤਿਆਰੀ ਦੇਣ ਵਿੱਚ ਸਹਾਇਕ ਹੁੰਦੇ ਹਨ ਜਿਵੇਂ ਕਿ ਫਿਜੀਕਲ ਟਰੇਨਿੰਗ ਤਕਨੀਕੀ ਮਾਈਕਰੋ ਟਰੇਸਟ ਦੀ ਸ਼ਕਤੀ ਅਤੇ ਦੂਜੇ ਮੈਚ ਸ਼ਾਮਿਲ ਹੈ ਤਾਨ ਅਤੇ ਸਹਾਇਕਾ ਟਰੇਨਰ ਖਿਡਾਰੀਆਂ ਦਾ ਤਾਨ ਉਠਾਉਂਦੇ ਹਨ ਅਤੇ ਉਹਨਾਂ ਨੂੰ ਮਾਰਕ ਦਰਸ਼ਨ ਦਿੰਦੇ ਹਨ ਕਿ ਕਿਵੇਂ ਉਹਨਾਂ ਨੂੰ ਉਹਨਾਂ ਦੇ ਹੁਨਰ ਅਤੇ ਪ੍ਰਦਰਸ਼ਨ ਵਿੱਚ ਸੁਧ ਧਾਰਾ ਕਰਨਾ ਹੈ ਉਹ ਉਹਨਾਂ ਦੀ ਹਰ ਤਰ੍ਹਾਂ ਦੀ ਸਹਾਇਕਤਾ ਕਰਦੇ ਹਨ ਸਹਾਇਤਾ ਕਰਦੇ ਹਨ ਜਿਸ ਨਾਲ ਉਹਨਾਂ ਦੀ ਤਿਆਰੀ ਅਤੇ ਪਰਫ਼ਿਟਨੈਸ ਵਿੱਚ ਸੁਧਾਰ ਆ ਸਕੇ ਸਮਰਥਾਂ ਨੂੰ ਪ੍ਰਬੰਧਿਤ ਕਰਨਾ ਟਰੇਨਰ ਦਾ ਇੱਕ ਹੋਰ ਮਹੱਤਵਪੂਰਨ ਅਸਥਾਨ ਹੁੰਦਾ ਹੈ ਕਿ ਉਹ ਖਿਡਾਰੀਆਂ ਦੇ ਸਮਰਥਨ ਅਤੇ ਕਿਸੇ ਵੀ ਤਰ੍ਹਾਂ ਦੇ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਇਕ ਹੁੰਦੇ ਹਨ ਉਹ ਉਹਨਾਂ ਦੀ ਕਰਨ ਅਤੇ ਮੈਚ ਸ਼ਾਮਿਲ ਹੋਣ ਵਾਲੀਆਂ ਤਮਾਮ ਮੁਸ਼ਕਿਲਾਂ ਦਾ ਨਿਵਾਰਨ ਕਰਦੇ ਹਨ ਇਸ ਤਰ੍ਹਾਂ ਟਰੇਨਰ ਖਿਡਾਰੀਆਂ ਨੂੰ ਵਧੀਆ ਖਿਡਾਰੀ ਅਤੇ ਉਹਨਾਂ ਦੀ ਸਫਲਤਾ ਵਿੱਚ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਸਪਸ਼ਟ ਦਾ ਨਿਰੀਪੱਖਣ ਕਰਨ ਵਿੱਚ ਮਦਦ ਕਰਦੇ ਹਨ